ਅੱਛਾ ਜੀ ਠੀਕ ਹੈ ਜੀ ਹਾਂਜੀ ਅਸੀਂ ਕੱਲ੍ਹ ਨੂੰ ਫਰੀ ਹਾਂ ਜੀ

ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅਤੇ ਉਹ ਓਰਿਜਨਲ ਚਾਹੀਦਾ ਜਾਂ ਫੋਟੋ ਸਟੇਟ ਚਾਹੀਦੀ ਜੀ ਠੀਕ ਹੈ ਜੀ ਠੀਕ ਹੈ ਜੀ ਅਤੇ ਗੁਆਂਡੀ ਕੋਈ ਵੀ ਹੋ ਸਕਦੇ ਹੈਗੇ ਆ ਜਾਂ ਕੋਈ ਮੈਮ ਜਾਂ ਕੋਈ ਪੰਜ ਠੀਕ ਹੈ ਸਰ ਹਾਂਜੀ ਸਰ ਠੀਕ ਹੈ ਸਰ ਠੀਕ ਹੈ ਸਰ ਹਾਂਜੀ ਠੀਕ ਹੈ ਜੀ